ਜੀ ਹਾਂ ਮੇਰੇ ਕੋਲ ਬੁਣਾਈ ਦਾ ਕੰਮ ਹੈ ਮੈਂ ਆਪਣੇ ਘਰੋਂ ਬੁਣਾਈ ਦਾ ਕੰਮ ਕਰਦੀ ਹਾਂ ਸਟਿਚਿੰਗ ਦਾ ਕੰਮ ਕਰਦੀ ਹਾਂ ਜਿੱਦਾਂ ਦਰੀਆਂ ਬੁਣਨਾ ਖੇਸ ਬੁਣਨਾ ਕੱਪੜੇ ਸਿਲਾਈ ਕਰਨਾ ਮੇਰਾ ਸ਼ੌਂਕ ਹੈ ਮੈਂ ਆਪਣੇ ਕੱਪੜੇ ਖੁਦ ਸਿਲਾਈ ਕਰਦੀ ਹਾਂ ਆਪਣੇ ਘਰ ਵੀ ਇੱਕ ਸਿਲਾਈ ਕਰਕੇ ਦਿੰਦੀ ਹਾਂ ਮੇਰਾ ਸ਼ੌਂਕ ਆ ਕਿ ਮੈਂ ਉੱਚੇ ਪੱਧਰ 'ਤੇ ਜਾਵਾਂ ਮੈਂ ਬੁਟੀਕ 'ਚ ਕੰਮ ਕ ਸੋਹਣੇ ਸੋਹਣੇ ਕੱਪੜੇ ਸਟਿੱਚ ਕਰਾਂ ਮੈਂ ਆਪਣਾ ਨਾਮ ਬਣਾਵਾਂ ਇਸ ਲਈ ਮੈਂ ਬੁਣਾਈ ਦਾ ਵੀ ਕੰਮ ਕਰਦੀ ਜਿੱਦਾਂ ਦਰੀਆਂ ਬੁਣਨਾ ਖੇਸ ਬੁਣਨਾ ਹੋਰ ਵੀ ਕਈ ਤਰ੍ਹਾਂ ਦੇ ਕੰਮ ਨੇ ਜੋ ਜਿਵੇਂ ਸਟਿਚਿੰਗ ਕਰਨਾ ਆਪਣੇ ਸੂਟ ਆਪ ਬਣਾਉਣਾ ਘਰ ਬਣਾ ਕੇ ਦੇਣੇ ਬੁਟੀਕ ਦਾ ਕੰਮ ਕਰਨਾ ਮੈਨੂੰ ਸ਼ੌਂਕ ਹੈ ਵੀ ਮੈਂ ਵਧੀਆ ਵਧੀਆ ਕੱਪੜੇ ਸੀਵਾਂ ਮਤਲਬ ਆਪਣਾ ਨਾਮ ਬਣਾਵਾਂ ਇਸ ਨਾਲ ਕੀ ਆ ਪਰ ਮੈਨੂੰ ਖੁਸ਼ੀ ਮਿਲਦੀ ਹੈ ਮੇਰਾ ਸ਼ੌਂਕ ਹੈ ਵੀ ਮੈਂ ਕੰਮ ਕਰਾਂ ਕੱਪੜੇ ਸਿਉਵਾਂ ਸਿਲਾਈ ਦਾ ਕੰਮ ਕਰਾਂ ਬੁਣਾ ਬਣਾਈ ਦਾ ਕੰਮ ਕਰਾਂ